ਸਤਿ ਸ਼੍ਰੀ ਅਕਾਲ ਜੀ ਰੁਤਬਾ ਰੈਸਟੋਰੈਂਟ ਸਰਹਿੰਦ ਤੋਂ ਬੋਲ ਰਹੇ ਹੋ ਜੀ ਮੈਂ ਹਰਪ੍ਰੀਤ ਸਿੰਘ ਬੋਲ ਰਿਹਾ ਜੀ ਮੈਂ ਤੁਹਾਡਾ ਔਨਲਾਈਨ ਔਡਰ ਬੁੱਕ ਕੀਤਾ ਸੀ ਪਨੀਰ ਟਿੱਕੇ ਦਾ ਜੀ ਔਡਰ ਬੁੱਕ ਹੋ ਗਿਆ ਸੀ ਅਤੇ ਤੁਹਾਡੇ ਡਿਲੀਵਰੀ ਪਾਟਨਰ ਦਾ ਨੰਬਰ ਸਕਰੀਨ 'ਤੇ ਆ ਰਿਹਾ ਸੀ ਮੈਂ ਉਸਨੂੰ ਕਾਲ ਕੀਤੀ ਤਾਂ ਉਸ ਨੇ ਮੈਨੂੰ ਥਰਟੀ ਮਿੰਟ ਦਾ ਟਾਈਮ ਦਿੱਤਾ ਪਰੰਤੂ ਹੁਣ ਚਾਲੀ ਮਿੰਟ ਹੋ ਚੁੱਕੇ ਨੇ ਨਾ ਉਹ ਫੋਨ ਚੱਕਦਾ ਅਤੇ ਨਾ ਹੀ ਮੇਰੇ ਕੋਲ ਔਡਰ ਪਹੁੰਚਿਆ ਕਿਰਪਾ ਕਰਕੇ ਮੈਨੂੰ ਦੱਸਿਆ ਜਾਵੇ ਕਿ ਮੇਰੇ ਔਡਰ ਦਾ ਕੀ ਬਣਿਆ ਔਡਰ ਆਵੇਗਾ ਜਾਂ ਕੈਂਸਲ ਆ ਪਲੀਜ਼ ਮੈਨੂੰ ਦੱਸਿਆ ਜਾਵੇ ਨਾ ਡਿਲੀਵਰੀ ਬੋਆਏ ਨੇ ਮੈਂ ਦੁਬਾਰਾ ਵੀ ਟਰਾਈ ਕੀਤੀ ਅਤੇ ਮੈਸੇਜ ਵੀ ਕੀਤਾ ਉਸ ਨੇ ਨਾ ਫੋਨ ਪਿੱਕ ਕੀਤਾ ਅਤੇ ਨਾ ਹੀ ਮੇਰੇ ਮੈਸੇਜ ਦਾ ਜਵਾਬ ਦਿੱਤਾ ਕਿਰਪਾ ਕਰਕੇ ਮੈਨੂੰ ਮੇਰੇ ਔਡਰ ਦਾ ਦੱਸਿਆ ਜਾਵੇ ਧੰਨਵਾਦ